ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਤੁਸੀਂ ਅੰਬਰਸਰੋਂ ਬੋਲਦੇ ਭਾਅ ਜੀ ਮੇਰੇ ਨਾ ਇੱਕ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਮੈਨੂੰ ਮੈਂ ਨਾ ਭਾਅ ਜੀ ਇੱਕ ਫੂਡ ਵਲੋਗਰ ਹੈਗਾ ਮੈਂ ਦਿੱਲੀ ਤੋਂ ਆਇਆ ਵਾਂ ਅੰਮ੍ਰਿਤਸਰ ਥੋੜ੍ਹੇ ਦਿਨ ਵਿਜਿਟ ਕਰਨਾ ਮੈਂ ਦਸ ਪੰਦਰ੍ਹਾਂ ਦਿਨ ਅਤੇ ਮੈਂ ਅੰਮ੍ਰਿਤਸਰ ਦੇ ਫੇਮਸ ਫਾਸਟ ਫੂਡ ਬਾਰੇ ਥੋੜ੍ਹਾ ਮੈਨੂੰ ਦੱਸ ਦਿਓ ਤਾਂ ਕਿ ਮੈਂ ਆਪਣੇ ਫੂਡ ਵਲੋਗਿੰਗ 'ਚ ਇਹਦੇ ਬਾਰੇ ਲੋਕਾਂ ਨੂੰ ਦੱਸ ਸਕਾਂ ਹਾਂਜੀ ਹਾਂਜੀ ਠੀਕ ਠੀਕ ਆ ਅਤੇ ਅੱਜ ਓਕੇ ਠੀਕ ਠੀਕ ਅਤੇ ਕੁਲਚਾ ਵਗੈਰਾ ਮਤਲਬ 'ਚ ਹਮੇਸ਼ਾਂ ਮਿਲਦਾ ਰਹਿੰਦਾ ਨਾ ਠੀਕ ਹੈ ਓਕੇ ਓਕੇ ਅਤੇ ਬਾਕੀ ਆਪਣਾ ਹੋਰ ਕੋਈ ਫਾਸਟ ਫੂਡ 'ਚ ਕੁਝ ਹੋਵੇ ਓਕੇ ਓਕੇ ਠੀਕ ਆ ਜੀ ਭਾਅ ਜੀ ਤੁਹਾਨੂੰ ਕੋਈ ਦਿੱਕਤ ਤਾਂ ਨਾ ਜੇ ਮੈਂ ਤੁਹਾਨੂੰ ਇਨ ਬਿਟਵੀਨ ਤੰਗ ਕਰਾ ਥੋੜ੍ਹਾ ਬਹੁਤ ਚਲੋ ਠੀਕ ਆ ਭਾਅ ਜੀ ਮੈਂ ਨਾ ਤੁਹਾਨੂੰ ਕਾਲ ਕਰਕੇ ਇੱਕ ਵਾਰੀ ਫਿਰ ਪੁੱਛ ਲਾਂਗੇ ਇੱਕ ਵਾਰੀ ਮੈਂ ਲੋਕੇਸ਼ਨ 'ਤੇ ਜਾ ਕੇ ਠੀਕ ਹੈ ਭਾਅ ਜੀ ਧੰਨਵਾਦ ਜੀ